ਭੰਗੜਾ ਮੁੰਡੇ ਅਤੇ ਕੁੜੀਆਂ ਦੋਨਾਂ ਵੱਲੋਂ ਪਾਇਆ ਜਾਂਦਾ ਹੈ ਭੰਗੜੇ ਅਤੇ ਪ੍ਰਦਰਸ਼ਨ ਲਈ ਮੁੰਡੇ ਅਤੇ ਕੁੜੀਆਂ ਵੱਲੋਂ ਵੱਖੋ ਵੱਖਰੀਆਂ ਪੁਸ਼ਾਕਾਂ ਪਹਿਨੀਆਂ ਜਾਂਦੀਆਂ ਹਨ ਆਮ ਤੌਰ ਉੱਤੇ ਮੁੰਡਿਆ ਵੱਲੋਂ ਕੁੜਤਾ ਚਾਦਰਾ ਕੁੜਤਾ ਪਜਾਮਾ ਅਤੇ ਸਿਰ ਉੱਤੇ ਪੇਚਾਂ ਵਾਲੀ ਪੱਗ ਸਜਾਈ ਜਾਂਦੀ ਹੈ ਅਤੇ ਕੁੜੀਆਂ ਵੱਲੋਂ ਸਲਵਾਰ ਸੂਟ ਜਾਂ ਕੁੜਤਾ ਧੋਤੀ ਪਾਈ ਜਾਂਦੀ ਹੈ ਅਤੇ ਵਾਲਾ ਵਿੱਚ ਪਰਾਂਦੀ ਪਾ ਕੇ ਸਿਰ ਉੱਤੇ ਚੁੰਨੀ ਲੈ ਕੇ ਭੰਗੜਾ ਪਾਇਆ ਜਾਂਦਾ ਹੈ ਇਹ ਪੋਸ਼ਾਕਾਂ ਡਾਂਸ ਕਰਨ ਵਾਲਿਆਂ ਨੂੰ ਹੋਰ ਆਕਰਸ਼ਿਤ ਬਣਾ ਦਿੰਦੀਆਂ ਹਨ ਕਿਉਂਕਿ ਆਮ ਤੌਰ ਉੱਤੇ ਅੱਜ ਕੱਲ੍ਹ ਇਹ ਪੁਸ਼ਾਕਾਂ ਰੋਜ਼ ਨਹੀਂ ਪਹਿਨੀਆਂ ਜਾਂਦੀਆਂ ਇਹ ਸਿਰਫ਼ ਡਾਂਸ ਪ੍ਰਦਰਸ਼ਿਤ ਕਰਨ ਵਿੱਚ ਹੀ ਪਹਿਨੀਆਂ ਜਾਂਦੀਆਂ ਹਨ ਅਤੇ ਇਹਨਾਂ ਵਿਚ ਆਮ ਤੌਰ ਉੱਤੇ ਹਰਾ ਪੀਲਾ ਨੀਲਾ ਰੰਗ ਪਾਇਆ ਜਾਂਦਾ ਹੈ ਜੋ ਕਿ ਅੱਖਾਂ ਨੂੰ ਆਪਣੇ ਵੱਲ ਦੂਰੋਂ ਹੀ ਆਕਰਸ਼ਿਤ ਕਰ ਲੈਂਦਾ ਹੈ ਜੇਕਰ ਸਾਨੂੰ ਕਿਸੇ ਦਾ ਭੰਗੜਾ ਜ਼ਿਆਦਾ ਪਸੰਦ ਆ ਜਾਵੇ ਤਾਂ ਅਸੀਂ ਉਹਨਾਂ ਨੂੰ ਉਹਨਾਂ ਦੀਆਂ ਪੋਸ਼ਾਕਾਂ ਵੱਲ ਦੇਖ ਕੇ ਵੀ ਪਹਿਚਾਣ ਸਕਦੇ ਹਾਂ